ਰੂਪਨਗਰ ਜ਼ਿਲ੍ਹੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪਾਰਟੀਆਂ ਹਨ ਭਾਵੇਂ ਉਹ ਭਾਜਪਾ ਹੋਏ ਕਾਂਗਰਸ ਹੋਏ ਆਮ ਆਦਮੀ ਪਾਰਟੀ ਹੋਏ ਜਾਂ ਅਕਾਲੀ ਦਲ ਹੋਏ ਇਸ ਤੋਂ ਇਲਾਵਾ ਅਜ਼ਾਦ ਉਮੀਦਵਾਰ ਵੀ ਰੂਪਨਗਰ ਜ਼ਿਲ੍ਹੇ ਵਿੱਚ ਐਕਟਿਵ ਹਨ ਹਾਂ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਸੀ ਜੋ ਕਿ ਪਹਿਲਾਂ ਐੱਮ ਐੱਲ ਏ ਸੀ ਅਤੇ ਫਿਰ ਉਹ ਮੁੱਖ ਮੰਤਰੀ ਬਣਿਆ ਜਿਸ ਮੁੱਖ ਮੰਤਰੀ ਬਣਨ ਦੇ ਦੌਰਾਨ ਉਸਨੇ ਬਹੁਤ ਸਾਰੇ ਵਾਅਦੇ ਕੀਤੇ ਜਿਸਦੇ ਵਿੱਚ ਬਿਜਲੀ ਦੇ ਬਿੱਲ ਉਹਨਾਂ ਵਿੱਚ ਕਟੌਤੀ ਆਦਿ ਵਾਅਦੇ ਸ਼ਾਮਲ ਸਨ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਵਾਅਦੇ ਸਿਰਫ ਵਾਅਦੇ ਹੀ ਰਹੇ ਅਤੇ ਉਹ ਪੂਰੇ ਨਹੀਂ ਹੋਏ ਉਸ ਤੋਂ ਬਾਅਦ ਦੀ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸਾਡੇ ਰੂਪਨਗਰ ਜ਼ਿਲ੍ਹੇ ਦੇ ਐੱਮ ਐੱਲ ਏ ਦਾ ਨਾਂ ਦਿਨੇਸ਼ ਚੱਡਾ ਹੈ ਹਾਂ ਉਹਨਾਂ ਨੇ ਮਾਈਨਿੰਗ ਦੇ ਉੱਤੇ ਰੋਕਥਾਮ ਕੀਤੀ ਹੈ ਅਤੇ ਕੋਲਜ ਸਰਕਾਰੀ ਕੋਲਜ ਰੂਪਨਗਰ ਨੂੰ ਡੇਢ ਕਰੋੜ ਦੀ ਗਰਾਂਟ ਵੀ ਮੁੱਹਈਆ ਕਰਵਾਈ ਹੈ